ਵੇਹਲੇ ਸਮੇਂ ਵਿੱਚ ਮੈਂ ਬਹੁਤ ਸਾਰੀਆਂ ਗੇਮ ਖੇਲਦੀ ਹਾਂ ਤਰ੍ਹਾਂ ਤਰ੍ਹਾਂ ਦੀਆਂ ਗੇਮ ਕਈ ਵਾਰ ਮੈਂ ਆਪਣੇ ਬੱਚਿਆਂ ਦੇ ਨਾਲ਼ ਖੇਲਦੀ ਹਾਂ ਜਾਂ ਫਿਰ ਮੈਂ ਕਈ ਖੇਡਾਂ ਮੈਂ ਇਕੱਲੀ ਹੀ ਖੇਲਣਾ ਪਸੰਦ ਕਰਦੀ ਹਾਂ ਪਰ ਸਭ ਤੋਂ ਜ਼ਿਆਦਾ ਮੈਨੂੰ ਚੈੱਸ ਖੇਲਣੀ ਪਸੰਦ ਹੈ ਕਿਉਂਕਿ ਚੈੱਸ ਇਕ ਦਿਮਾਗੀ ਖੇਡ ਹੈ ਅਤੇ ਇਸਨੂੰ ਖੇਡ ਕੇ ਬੰਦਾ ਐਕਟਿਵ ਰਹਿੰਦਾ ਹੈ ਇਹ ਗੇਮ ਇਕੱਲੀ ਵੀ ਖੇਡੀ ਜਾ ਸਕਦੀ ਹੈ ਵੇਹਲੇ ਸਮੇਂ ਵਿੱਚ ਇਸ ਨੂੰ ਖੇਡ ਕੇ ਮੈਂ ਆਪਣਾ ਸਮਾਂ ਚੰਗਾ ਬਤੀਤ ਕਰ ਲੈਂਦੀ ਹਾਂ ਇਹ ਇੱਕ ਬਹੁਤ ਹੀ ਰੋਮਾਂਚਕ ਖੇਡ ਹੈ ਜਿਸ ਵਿੱਚ ਹਾਥੀ ਘੋੜੇ ਪਿਆਦੇ ਰਾਜਾ ਸਭ ਕੁਝ ਹੈ ਅਤੇ ਮੈਂ ਕਦੇ ਕਦੇ ਇਸ ਵਿੱਚ ਰਾਜਾ ਬਣਨ ਦੀ ਕੋਸ਼ਿਸ਼ ਕਰਦੀ ਐਂ ਅਤੇ ਕਦੇ ਮੈਂ ਇੱਕ ਪਿਆਦਾ ਬਣ ਕੇ ਹੀ ਖੁਸ਼ ਰਹਿੰਦੀ ਹਾਂ ਅਤੇ ਜਿੱਤ ਹਾਰ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ ਜੇ ਇਸ ਗੇਮ ਲਈ ਵਿੱਚ ਖੇਡਣ ਲਈ ਮੈਨੂੰ ਚੰਗਾ ਸਾਥੀ ਮਿਲ ਜਾਵੇ ਉਹਦੇ ਵਰਗੀ ਕੋਈ ਰੀਸ ਹੀ ਨਹੀਂ ਅਤੇ ਬਸ ਸਭ ਗੱਲਾਂ ਨਾਲੋਂ ਗੱਲਾਂ ਮੈਨੂੰ ਇਹ ਖੇਡ ਬਹੁਤ ਹੀ ਪਸੰਦ ਹੈ